ਮੈਂ ਹਿਮਾਚਲ ਪ੍ਰਦੇਸ਼ ਵਿੱਚ ਯਾਤਰਾ ਲਈ ਗਈ ਹਿਮਾਚਲ ਪ੍ਰਦੇਸ਼ ਮੇਰਾ ਸਭ ਤੋਂ ਸੁੰਦਰ ਇਲਾਕਾ ਹੈ ਇਹ ਇਲਾਕਾ ਪਹਾੜਾਂ ਜੰਗਲਾਂ ਵਿੱਚ ਸਥਿਤ ਹੈ ਇਸ ਇਲਾਕੇ ਵਿੱਚ ਜਦੋਂ ਅਸੀਂ ਪਹਾੜਾਂ ਦੀ ਯਾਤਰਾ ਲਈ ਪੜਾ ਪਹਾੜੀ ਚੜਾਈ ਚੜ੍ਹਦੇ ਹਾਂ ਤਾਂ ਸਾਨੂੰ ਬਹੁਤ ਹੀ ਨਜ਼ਾਰਾ ਆਉਂਦਾ ਹੈ ਇਸ ਇਸ ਦਾ ਦ੍ਰਿਸ਼ ਬਹੁਤ ਹੀ ਸ਼ਾਨਦਾਰ ਹੁੰਦਾ ਹੈ ਇਸ ਵਿੱਚ ਸੰਘਣੇ ਸੰਘਣੇ ਜੰਗਲ ਬਹੁਤ ਹੀ ਅਨੰਦਦਾਇਕ ਹੁੰਦੇ ਹਨ ਅਤੇ ਬਰਫ਼ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਦਾ ਦ੍ਰਿਸ਼ ਬਹੁਤ ਹੀ ਸੋਹਣਾ ਲੱਗਦਾ ਹੈ ਇੱਥੇ ਹਿਮਾਚਲ ਪ੍ਰਦੇਸ਼ ਵਿੱਚ ਬਾਂਦਰ ਨਾਂ ਦਾ ਜਾਨਵਰ ਬਹੁਤ ਹੀ ਮਸ਼ਹੂਰ ਹੈ ਇਸ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਅਤੇ ਸੂਰਜ ਸੂਰਜ ਡੁੱਬਣ ਦਾ ਦ੍ਰਿਸ਼ ਬਹੁਤ ਹੀ ਸੋਹਣਾ ਲੱਗਦਾ ਹੈ